ਸਰ ਸਤਿ ਸ਼੍ਰੀ ਅਕਾਲ ਸਰ ਮੈਂ ਹਰਜੀਤ ਕੋਲ ਬੋਲ ਰਹੀ ਹਾਂ ਪਠਾਨਕੋਟ ਤੋਂ ਮੈਂ ਤੁਹਾਡੇ ਰੈਸਟੋਰੈਂਟ 'ਚ ਖਾਣਾ ਬੁੱਕ ਕਰਵਾਇਆ ਸੀ ਜਿਸ ਵਿੱਚ ਕੁਝ ਮੈਂ ਚਾਰ ਪੰਜ ਚੀਜ਼ਾਂ ਬੁੱਕ ਕਰਵਾਈਆਂ ਸਨ ਦਾਲ ਰਾਜਮਾਹ ਚਾਵਲ ਕੇਕ ਮ ਪਨੀਰ ਜੋ ਜੋ ਕਿ ਬਹੁਤ ਲੇਟ ਪਹੁੰਚਿਆ ਅਤੇ ਮੇ ਮੇਰੇ ਘਰ ਗੈਸਟ ਆਏ ਹੋਏ ਸਨ ਮੇਰੀ ਛੋਟੀ ਬੇਟੀ ਦਾ ਜਨਮਦਿਨ ਸੀ ਜਨਮਦਿਨ ਦੇ ਵਿੱਚ ਜੋ ਗੈਸਟ ਆਏ ਸਨ ਉਹਨਾਂ ਨੂੰ ਲੇਟ ਖਾਣਾ ਪਹੁੰਚਣ ਦੇ ਕਾਰਣ ਮੇਰੀ ਕਾਫ਼ੀ ਬੇਇੱਜ਼ਤੀ ਹੋਈ ਜੋ ਕਿ ਮੇਰੀ ਬੇਇੱਜ਼ਤੀ ਵਾਪਿਸ ਨਹੀਂ ਆ ਸਕਦੀ ਤੁਹਾਡੇ ਖਾਣਾ ਲੇਟ ਪਹੁੰਚਣ ਦੇ ਨਾਲ ਅਤੇ ਹੁਣ ਜੋ ਵੀ ਮਤਲਬ ਕਿ ਬੇ ਗੈਸਟ ਨਾਰਾਜ਼ ਹੋ ਕੇ ਚਲੇ ਗਏ ਨ ਨਾਰਾਜ਼ ਹੋ ਕੇ ਚਲੇ ਗਏ ਅਤੇ ਉਹ ਵੈਸੇ ਤਾਂ ਤੁਹਾਡੀ ਖਾਣਾ ਤਾਂ ਬਹੁਤ ਸੁਆਦ ਸੀ ਪਰ ਜੋ ਖਾਣਾ ਲੇਟ ਹੋਇਆ ਇਸ ਕਰਕੇ ਮੈਨੂੰ ਤੁਹਾਡੀ ਸਰਵਿਸ ਕੁਛ ਕ ਪਸੰਦ ਨਹੀਂ ਆਈ ਅਤੇ ਹੁਣ ਜੋ ਵੀ ਮੇਰਾ ਰਿਫੰਡ ਆ ਉਹ ਵਾਪਿਸ ਕੀਤਾ ਜਾਵੇ